ਸਾਡੇ ਖੇਤਰ ਵਿੱਚ ਮੌਤ ਦਰ ਮੌਜੂਦ ਹੈ ਪਰ ਬਾਲ ਮੌਤ ਦਰ ਵਧੇਰੇ ਉੱਚੀ ਨਹੀਂ ਹੈ ਸਗੋਂ ਦਰਮਿਆਨੇ ਰੂਪ ਵਿੱਚ ਹੈ ਸਾਡੇ ਖੇਤਰ ਵਿੱਚ ਮੌਤ ਦਰ ਦੇ ਮੁੱਖ ਰੂਪ ਵਿੱਚ ਕਾਫੀ ਕਾਰਨ ਹਨ ਸਭ ਤੋਂ ਪਹਿਲਾ ਕਾਰਨ ਲੋਕਾਂ ਦਾ ਅਸੰਤੁਲਿਤ ਖਾਣ ਪੀਣ ਹੈ ਲੋਕ ਘਰ ਦਾ ਖਾਣਾ ਖਾਣ ਦੀ ਥਾਂ ਬਾਹਰ ਦਾ ਖਾਣਾ ਖਾਣਾ ਪਸੰਦ ਕਰਦੇ ਹਨ ਦੂਜੇ ਪਾਸੇ ਬਾਲ ਮੌਤ ਦਰ ਤੋਂ ਬਚਣ ਲਈ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਚ ਕਾਫੀ ਬਿਮਾਰੀਆਂ ਤੋਂ ਬਚਾਅ ਕਰਨ ਵਾਲੇ ਟੀਕੇ ਬੱਚਿਆਂ ਦੇ ਲਗਾਏ ਜਾਂਦੇ ਹਨ ਸਰਕਾਰੀ ਸਕੀਮਾਂ ਦੁਆਰਾ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਸਮੇਂ ਸਮੇਂ 'ਤੇ ਪਿਲਾਈਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਸਰਕਾਰ ਦੁਆਰਾ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਬੱਚਿਆਂ ਨੂੰ ਬਿਮਾਰੀ ਤੋਂ ਬਚਣ ਲਈ ਉਹਨਾਂ ਦੇ ਮਾਪਿਆਂ ਨੂੰ ਜਾਗਰੂਕ ਕਰਦੇ ਹਨ ਸਰਕਾਰ ਦੁਆਰਾ ਬੱਚਿਆਂ ਨੂੰ ਕਾਫੀ ਪ੍ਰਕਾਰ ਦੀਆਂ ਭੋਜਨ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ